ਪੰਜਾਬ ਸਰਕਾਰ ਵੱਲੋਂ ਅੱਜ ਕੱਲ੍ਹ ਸਿੱਖਿਆ ਅਤੇ ਹੈਲਥ ਅਤੇ ਸਿਹਤ 'ਤੇ ਬਹੁਤ ਜ਼ਿਆਦਾ ਜੋਰ ਦਿੱਤਾ ਜਾ ਰਿਹਾ ਹੈ ਐਜੂਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਮੁਫ਼ਤ ਸਿੱਖਿਆ ਦੇਣ ਦੇਣਾ ਆਪਣਾ ਪਹਿਲਾ ਕਰਤੱਵ ਸਮਝਿਆ ਹੈ ਗਰੀਬ ਪਰਿਵਾਰ ਹੋਵੇ ਜਾਂ ਮਿਡਲ ਕਲਾਸ ਦਾ ਬੱਚਾ ਹੋਵੇ ਕੋਈ ਵੀ ਬੱਚਾ ਹੋਵੇ ਸਰਕਾਰੀ ਸਕੂਲ ਦੇ ਵਿੱਚ ਅੱਠਵੀਂ ਜਮਾਤ ਤੱਕ ਮੁਫ਼ਤ ਸਿੱਖਿਆ ਦੀ ਐਜੂਕੇਸ਼ਨ ਲੈ ਰਿਹਾ ਹੈ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਅੱਗੇ ਲਿਆਉਣ ਲਈ ਪੰਜਾਬ ਦੇ ਵਿੱਚ ਸਮਾਰਟ ਸਕੂਲ ਖੋਲ੍ਹੇ ਜਾ ਰਹੇ ਹਨ ਜਿਸ ਕਰਕੇ ਪੰਜਾਬ ਦੇ ਵਿੱਚ ਬੱਚਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਐਜੂਕੇਸ਼ਨ ਮਨਿਸਟਰ ਅਤੇ ਖੇਡ ਮੰਤਰਾਲੇ ਵੱਲੋਂ ਖੇਡਾਂ ਅਤੇ ਐਜੂਕੇਸ਼ਨ 'ਤੇ ਬਹੁਤ ਜ਼ਿਆਦਾ ਜੋਰ ਦਿੱਤਾ ਗਿਆ ਹੈ ਅਤੇ ਵਧੀਆ ਵਧੀਆ ਢਾਂਚੇ ਦਾ ਸਟਾਫ ਵਧੀਆ ਢਾਂਚੇ ਦੀ ਸਕੂਲਿੰਗ ਬਿਲਡਿੰਗ 'ਤੇ ਬਹੁਤ ਜ਼ਿਆਦਾ ਸਰਕਾਰ ਵੱਲੋਂ ਜੋਰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਐਜੂਕੇਸ਼ਨ ਦਾ ਪੱਧਰ ਵਧੀਆ ਕਰਨ ਵਾਸਤੇ ਸਕੂਲਾਂ ਦੇ ਵਿੱਚ ਵਧੀਆ ਕੁਆਲੀਫਾਈ ਟੀਚਰ ਟੈਟ ਪਾਸ ਮਾਸਟਰ ਕੇਡਰ ਈ ਟੀ ਟੀ ਸਕਰੀਨਿੰਗ ਟੈਸਟ ਕਰਕੇ ਹੀ ਯੋਗਤਾ ਵਾਲੇ ਟੀਚਰਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਅਤੇ ਜਿਸ ਕਰਕੇ ਪੰਜਾਬ ਦੇ ਸਕੂਲਾਂ ਦਾ ਸਿਸਟਮ ਵਧੀਆ ਬਣ ਸਕੇ ਅਤੇ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਦਿਨੋ ਦਿਨ ਘਟਦੀ ਜਾ ਰਹੀ ਹੈ ਅਤੇ ਹੁਣ ਪੇਂਡੂ ਪੱਧਰ ਅਤੇ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਮਾਂ ਪਿਓ ਸਰਕਾਰੀ ਵੱਲ ਕੀ ਹੈ ਦਾਖਲੇ ਦੀ ਪਰਮੀਸ਼ਨ ਦੇ ਰਹੇ ਹੈ ਅਤੇ ਇਸ ਤਰ੍ਹਾਂ ਐਜੁਕੇਸ ਐਜੂਕੇਸ਼ਨ ਸਿਸਟਮ ਹੈ ਜਿਹੜਾ ਐਜੂਕੇਸ਼ਨ ਸਿਸਟਮ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਅਤੇ ਬੱਚਿਆਂ ਦਾ ਦਾਖਲੇ ਦੇ ਵਿੱਚ ਵੀ ਬਹੁਤ ਗਿਣਤੀ ਵਿੱਚ ਵਾਧਾ ਹੋ ਰਿਹਾ ਅਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹੋਈਆਂ ਹਨ ਬੱਚਿਆਂ ਦੇ ਕੁਝ ਜੀ ਕੇ ਟੈਸਟ ਲਏ ਜਾਂਦੇ ਹਨ ਜੋ ਬੱਚੇ ਅੱਵਲ ਆਉਂਦੇ ਹਨ ਉਹਨਾਂ ਲਈ ਅਲੱਗ ਅਲੱਗ ਸਕੀਮਾਂ ਅਲੱਗ ਅਲੱਗ ਇਨਾਮ ਦਾ ਪ੍ਰਬੰਧ ਕਰਦੀ ਹੈ ਪੰਜਾਬ ਸਰਕਾਰ ਨੇ ਹੈਲਥ 'ਤੇ ਵੀ ਬਹੁਤ ਜ਼ਿਆਦਾ ਜੋਰ ਦਿੱਤਾ ਹੈ ਪੰਜਾਬ ਸਰਕਾਰ ਨੇ ਵੱਖ ਵੱਖ ਵੱਖ ਵੱਖ ਸ਼ਹਿਰਾਂ ਵੱਖ ਵੱਖ ਪੇਂਡੂ ਖ ਪੇਂਡੂ ਖੇਤਰਾਂ ਦੇ ਵਿੱਚ ਮਹੱਲਾ ਕਲੀਨਕ ਖੋਲ੍ਹਣ ਦੀ ਵਿਵਸਥਾ ਕੀਤੀ ਹੈ ਅਤੇ ਵੱਡੇ ਸ਼ਹਿਰਾਂ ਵਿੱਚ ਵੱਡੇ ਹਸਪਤਾਲਾਂ ਦਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਗਰੀਬ ਪਰਿਵਾਰਾਂ ਨੂੰ ਪੰਜ ਲੱਖ ਦੇ ਕਾਰਡ ਦੀ ਵੀ ਸਹਾਇਤਾ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੇ ਦਿਨੋ ਦਿਨ ਹੈਲਥ ਅਤੇ ਐਜੂਕੇਸ਼ਨ 'ਤੇ ਜੋਰ ਦੇ ਰਹੀ ਹੈ ਅਤੇ ਪੰਜਾਬ ਵਿਕਾਸ ਦੇ ਰਾਹ 'ਤੇ ਜਾ ਰਿਹਾ ਹੈ ਅਤੇ ਬੁਨਿਆਦੀ ਢਾਂਚਾ ਬੁਨਿਆਦੀ ਢਾਂਚਾ ਕੀ ਹੁੰਦਾ ਗਾ ਬੁਨਿਆਦੀ ਢਾਂਚਾ ਕੋਈ ਵਿਅਕਤੀ ਦਾ ਖੁਦ ਦਾ ਆਪਣਾ ਛੋਟਾ ਮੋਟਾ ਕੰਮ ਹੁੰਦਾ ਉਹਨੂੰ ਅਸੀਂ ਕੀ ਕਹਿ ਸਕਦੇ ਹਾਂ ਬੁਨਿਆਦੀ ਢਾਂਚਾ ਕਹਿ ਸਕਦੇ ਹਾਂ